ਸਰੀਰਕ ਕਸਰਤ ਅਤੇ ਯੋਗਾ ਵਿੱਚ ਇੱਕ ਅੰਤਰ ਤਾਂ ਹੈ ਇੱਕ ਦੂਜੇ ਤੋਂ ਵੱਖਰੇ ਹਨ ਯੋਗਾ ਸ਼ੁਰੂ ਤੋਂ ਰਿਸ਼ੀ ਮੁਨੀ ਕਰਦੇ ਸੀ ਉਹ ਯੋਗ ਅਭਿਆਸ ਕਰਦੇ ਸੀ ਕਈ ਕਈ ਸਾਲਾਂ ਤੱਕ ਉਹ ਯੋਗ ਵਿੱਚ ਬੈਠੇ ਰਹਿੰਦੇ ਸਨ ਉਹਨਾਂ ਦੀ ਉਮਰ ਕਾਫੀ ਲੰਮੀ ਹੋ ਜਾਂਦੀ ਸੀ ਇਸੇ ਤਰ੍ਹਾਂ ਇਹ ਯੋਗ ਅਤੇ ਕਸਰਤ ਵਿੱਚ ਇਹ ਅੰਤਰ ਹੈ ਸਰੀਰਕ ਕਸਰਤ ਵਿਦੇਸ਼ੀ ਤਰੀਕਾ ਹੈ ਇਸ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਲੋੜ ਹੈ ਜਿਵੇਂ ਕਿ ਭੱਜਣ ਲਈ ਬੂਟ ਚਾਹੀਦੇ ਹਨ ਲੋਕ ਕਈ ਜਿਮ ਜਾਂਦੇ ਹਨ ਉੱਥੇ ਭੱਜਣ ਲਈ ਮਸ਼ੀਨਾਂ ਭਾਰ ਚੁੱਕਣਾ ਆਦਿ ਮਸ਼ੀਨਾਂ ਚਾਹੀਦੀਆਂ ਹਨ ਜੋ ਮਸ਼ੀਨਾਂ ਬਹੁਤ ਮਹਿੰਗੀਆਂ ਆਉਂਦੀਆਂ ਹਨ ਪਰ ਯੋਗੇ ਲਈ ਸਿਰਫ ਇੱਕ ਮੈਟ ਜਾਂ ਚਾਦਰ ਚਾਹੀਦੀ ਹੈ ਜਿੱਥੇ ਅਸੀਂ ਜਦੋਂ ਮਰਜ਼ੀ ਬੈਠ ਕੇ ਅਸੀਂ ਯੋਗ ਕਰ ਸਕਦੇ ਹਾਂ ਕਸਰਤ ਵਿੱਚ ਭੱਜ ਦੌੜ ਉਛਲ ਕੁੱਦ ਹੁੰਦੀ ਹੈ ਯੋਗੇ ਵਿੱਚ ਆਰਾਮ ਨਾਲ ਬੈਠ ਕੇ ਅਸੀਂ ਕਰ ਸਕਦੇ ਹਾਂ ਯੋਗ ਯ ਯੋਗੇ ਵਿੱਚ ਸਾਨੂੰ ਮੁੱਖ ਤੌਰ 'ਤੇ ਧਿਆਨ ਲਾਉਣਾ ਪੈਂਦਾ ਹੈ ਸਰੀਰਕ ਦਿਮਾਗ ਨੂੰ ਇੱਕ ਸੁਰ ਰੱਖਦੇ ਹਾਂ ਉਸੇ ਪਲ ਵਿੱਚ ਰਹਿੰਦੇ ਹਾਂ ਜਿਵੇਂ ਅੱਜ ਕੱਲ੍ਹ ਲੋਕਾਂ ਨੂੰ ਸਿਜਕ ਦੇ ਸਰੀਰ ਅਤੇ ਸਰੀਰਕ ਦੇ ਨਾਲ ਨਾਲ ਮਾਨਸਿਕ ਬਿਮਾਰੀਆਂ ਵੀ ਲੱਗਦੀਆਂ ਹਨ ਜਿਵੇਂ ਕਿ ਦਿਮਾਗੀ ਬੋਝ ਟੈਨਸ਼ਨ ਆਦਿ ਯੋਗੇ 'ਚ ਅਸੀਂ ਮਾਨਸਿਕ ਪੱਖ ਤੋਂ ਤੰਦਰੁਸਤ ਰਹਿੰਦੇ ਹਾਂ ਯੋਗਾ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਇਸੇ ਅਯੋਗਾ ਕਰਦੇ ਸਮੇਂ ਆਸਣ ਚੰਗੀ ਤਰ੍ਹਾਂ ਕਰਦੇ ਹਾਂ ਤਾਂ ਕਿ ਬਾਅਦ ਵਿੱਚ ਸਰੀਰ ਨੂੰ ਤਕਲੀਫ ਨਾ ਹੋਵੇ ਇਸ ਦੇ ਨਾਲ ਆਪਾਂ ਉਸ ਪਲ ਵਿੱਚ ਹੀ ਰਹਿ ਸਕਦੇ ਹਾਂ ਆਪਾਂ ਦਿਮਾਗ ਅਤੇ ਸਰੀਰ ਵਿੱਚ ਇੱਕ ਸੁਰਤ ਹੋ ਜਾਂਦੀ ਹੈ ਪੂਰਾ ਧਿਆਨ ਲਾਉਣਾ ਪੈਂਦਾ ਹੈ ਯੋਗੇ ਅਤੇ ਕਸਰਤ ਵਿੱਚ ਇਹ ਕਾਫੀ ਫਰਕ ਹੈ ਕਸਰਤ ਅਸੀਂ ਭੱਜ ਦੌੜ ਕਰਦੇ ਹਾਂ ਭੱਜਦੇ ਹਾਂ ਰੋਜ਼ ਸੁਬਹਾ ਉੱਠਦੇ ਹਾਂ ਭੱਜਦੇ ਹਾਂ ਭੱਜਣਾ ਭੱਜਣ ਜਾਂਦੇ ਹਾਂ ਉਹਦੇ ਵਿੱਚ ਸਾਨੂੰ ਕਈ ਵਾਰੀ ਤਕਲੀਫ ਵੀ ਹੋ ਜਾਂਦੀ ਹੈ ਪਰ ਯੋਗਾ ਕਰਦੇ ਸਮੇਂ ਸਾਨੂੰ ਇਹ ਇੰਨੀ ਤਕਲੀਫ ਨਹੀਂ ਹੁੰਦੀ ਅਸੀਂ ਆਰਾਮ ਨਾਲ ਯੋਗ ਬਹਿ ਕੇ ਆਰਾਮ ਨਾਲ ਕਰ ਸਕਦੇ ਹਾਂ ਅਤੇ ਉਹਦੇ ਵਿੱਚ ਕੁਝ ਉਛਲ ਕੁੱਦ ਦੀ ਲੋੜ ਨਹੀਂ ਪੈਂਦੀ ਬਿਮਾਰੀਆਂ ਵੀ ਨਹੀਂ ਲੱਗਦੀਆਂ ਬਹੁਤ ਘੱਟ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਬਿਮਾਰੀਆਂ ਤੋਂ ਬਚੇ ਰਹਿਣਾ ਤਾਂ ਯੋਗ ਕਰਨਾ ਬਹੁਤ ਜ਼ਰੂਰੀ ਹੈ ਅਤੇ ਅਸੀਂ ਮਾਨਸਿਕ ਪੱਖ ਤੋਂ ਤੰਦਰੁਸਤ ਹੁੰਦੇ ਹਾਂ ਅਤੇ ਯੋਗੇ ਅਤੇ ਬਹੁਤ ਜ਼ਿਆਦਾ ਸਾਨੂੰ ਇਹ ਪਰੇਸ਼ਾਨੀਆਂ ਪਰੇਸ਼ਾਨੀਆਂ ਤੋਂ ਵੀ ਬਚਾਉਂਦਾ ਹੈ ਕਿਉਂਕਿ ਜੋ ਵੀ ਸਾਡੇ ਮਨ ਵਿੱਚ ਪਰੇਸ਼ਾਨੀ ਹੁੰਦੀ ਹੈ ਉਹ ਸਾਨੂੰ ਯੋਗ ਕਰਨ ਤੋਂ ਅਸੀਂ ਧਿਆਨ ਨਾਲ ਜੋ ਕਰਦੇ ਹਾਂ ਤਾਂ ਸਾਨੂੰ ਉੱਧਰ ਆਸੇ ਪਾਸੇ ਦਾ ਜੋ ਵੀ ਹੈ ਸਾਨੂੰ ਉਹ ਪਾਸੇ ਅੱਖਾਂ ਤੋਂ ਪਰੋਖੇ ਸਾਨੂੰ ਕਰ ਦਿੰਦਾ ਹੈ ਵੀ ਸਾਨੂੰ ਜਿਵੇਂ ਕੋਈ ਬਿਮਾਰੀ ਨਹੀਂ ਹੁੰਦੀ ਅਤੇ ਬਿਮਾਰੀਆਂ ਲਈ ਸਾਨੂੰ ਯੋਗ ਕਰਨਾ ਬਹੁਤ ਜ਼ਰੂਰੀ ਹੈ